ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਹਾਂਜੀ ਜੀ ਜ਼ਰੂਰ ਜੀ ਮੈਂ ਉਹਨਾਂ ਬਾਰੇ ਜਾਣਕਾਰੀ ਤੁਹਾਨੂੰ ਜ਼ਰੂਰ ਦੇਵਾਂਗੀ ਜੀ ਹਾਂਜੀ ਜਿਹੜੇ ਧਰਮਿੰ ਹਾਂਜੀ ਜਿਹੜੇ ਧਰਮਿੰਦਰ ਭਾਅ ਜੀ ਆ ਉਹ ਵੀ ਜਿਹੜੇ ਉਹਨਾਂ ਦਾ ਪਿਛੋਕੜ ਜਿਹੜਾ ਉਹ ਵੀ ਪੰਜਾਬ ਤੋਂ ਹੀ ਹੈ ਉਹ ਪੰਜਾਬ ਦੇ ਹੀ ਜੰਮਪਲ ਹੈ ਪੰਜਾਬ ਦੇ ਹੀ ਰਹਿਣ ਵਾਲੇ ਆ ਅਤੇ ਉਹ ਹਿੰਦੀ ਫਿਲਮਾਂ 'ਚ ਵੀ ਕੰਮ ਕਰਦੇ ਆ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਦੇ ਆ ਉਹਨਾਂ ਦੇ ਬੇਟੇ ਵੀ ਜਿਹੜੇ ਸੰਨੀ ਦਿਓਲ ਬੋਬੀ ਦਿਓਲ ਉਹ ਵੀ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਦੇ ਆ ਅਤੇ ਹਿੰਦੀ ਫਿਲਮਾਂ 'ਚ ਵੀ ਉਹ ਕੰਮ ਕਰਦੇ ਆ ਪੰਜਾਬ ਦੇ ਕਲਾਕਾਰ ਵੀ ਜਿਹੜੇ ਦੇ ਏ ਕਲਾਕਾਰ ਆ ਉਹ ਹਿੰਦੀ ਫਿਲਮਾਂ 'ਚ ਵੀ ਕੰਮ ਕਰਦੇ ਆ ਅਤੇ ਪੰਜਾਬੀ ਫਿਲਮਾਂ 'ਚ ਵੀ ਉਹ ਗਾਣੇ ਆਪਣੇ ਦਿੰਦੇ ਆ ਹਿੰਦੀ 'ਚ ਵੀ ਦਿੰਦੇ ਆ ਕੰਮ ਵੀ ਕਰਦੇ ਦਲੇਰ ਮਹਿੰਦੀ ਸਤਿੰਦਰ ਸਿੰਘ ਲਾਭ ਜੰਜੂਆ ਮੀਕਾ ਸਿੰਘ ਜੀ ਅਤੇ ਇੱਦਾਂ ਕਰਕੇ ਜਿਹੜੇ ਸਾਰੇ ਕਲਾਕਾਰ ਆ ਜਿਹੜੇ ਐਕਟਰ ਆ ਜਿਹੜੇ ਉਹ ਜਿਵੇਂ ਸ਼ਿਮੀ ਜਿੰਮੀ ਸ਼ੇਰਗਿੱਲ ਵੀ ਪੰਜਾਬੀ ਫਿਲਮਾਂ ਵੀ ਕਰਦੇ ਆ ਹਿੰਦੀ ਫਿਲਮਾਂ ਵੀ ਕਰਦੇ ਆ ਅਕਸ਼ੈ ਕੁਮਾਰ ਵੀ ਸੋਨਮ ਬਾਜਵਾ ਵੀ ਇੱਦਾਂ ਕਰਕੇ ਜਿਹੜੇ ਕਲਾਕਾਰ ਐਕਟਰ ਆ ਉਹ ਹਿੰਦੀ ਫਿਲਮਾਂ 'ਚ ਵੀ ਉਹ ਆਪਣਾ ਕੰਮ ਕਰ ਰਹੇ ਆ ਅਤੇ ਪੰ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਦੇ ਉਹਨਾਂ ਦਾ ਸਾਰਾ ਪਿਛੋਕੜ ਜਿਹੜਾ ਵਾ ਪੰਜਾਬ ਤੋਂ ਹੀ ਹੈ ਥੈਂਕ ਯੂ ਜੀ ਥੈਂਕ ਯੂ ਜੀ ਓਕੇ ਜੀ